ਸਾਡੇ ਘਰ ਵਿੱਚ ਜੋ ਵੀ ਪਕਵਾਨ ਆ ਜੇ ਕਿਸੇ ਦੇ ਉਹ ਡਿਪੈਂਡ ਕਰਦਾ ਹੈ ਕਿਸੇ ਨੂੰ ਕੀ ਬਿਮਾਰੀ ਆ ਉਸ ਅਡ ਅਕੋਡਿੰਗ ਬਣਾਇਆ ਜਾਂਦਾ ਆ ਕਿ ਜਿਵੇਂ ਮੰਨ ਲਓ ਕਿ ਅਗਰ ਕਿਸੇ ਦਾ ਪੇਟ ਦਰਦ ਹੋ ਰਿਹਾ ਹੈ ਅਤੇ ਉਹਨੂੰ ਖਾਣਾ ਨਹੀਂ ਪਚ ਰਿਹਾ ਤਾਂ ਅਸੀਂ ਉਹਨੂੰ ਹਲਕਾ ਫੁਲਕਾ ਜਿਵੇਂ ਖਿਚੜੀ ਵਗੈਰਾ ਜਾਂ ਦਲੀਆ ਵਗੈਰਾ ਉਹਨੂੰ ਬਣਾ ਕੇ ਦਈਦਾ ਹੈ ਤਾਂ ਕਿ ਉਹ ਹਲਕਾ ਫੁਲਕਾ ਖਾਣਾ ਖਾਵੇ ਅਤੇ ਉਸਨੂੰ ਜ਼ਿਆਦਾ ਪ੍ਰੋਬਲਮ ਨਾ ਹੋਵੇ ਅਤੇ ਅਗਰ ਮੰਨ ਲਓ ਕਿ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਜਾਂ ਠੰਡ ਲੱਗ ਰਹੀ ਹੈ ਤਾਂ ਮੇਰੇ ਮੰਮਾ ਕ ਮੇਰੇ ਮੰਮਾ ਇੱਕ ਰੈਸਪੀ ਬਣਾਉਂਦੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਪਾਣੀ ਜਿਵੇਂ ਮੰਨ ਲਉ ਇੱਕ ਗਿਲਾਸ ਪਾਣੀ ਲਿਆ ਅਤੇ ਉਸ ਵਿੱਚ ਪਤਾਸੇ ਹੁੰਦੇ ਆ ਮਿੱਠਾ ਉਹ ਪਾਈਦਾ ਹੈ ਅਤੇ ਕੁਛ ਕਾਲੀ ਮਿਰਚ ਲੋਂਗ ਔਰ ਅਦਰਕ ਅਦ ਅਦਰਕ ਦਾ ਪੇਸਟ ਬਣਾ ਕੇ ਉਹ ਸਾਰਾ ਪਾਈਦਾ ਹੈ ਅਤੇ ਜ ਉਹਨੂੰ ਉਦੋਂ ਤੱਕ ਗਰਮ ਕੀਤਾ ਜਾਂਦਾ ਹੈ ਜਦੋਂ ਤੱਕ ਉਹ ਇੱਕ ਗਿਲਾਸ ਅੱਧਾ ਨਾ ਰਹਿ ਜਾਵੇ ਅਤੇ ਉਸ ਤੋਂ ਬਾਅਦ ਜੋ ਹੈ ਉਹ ਥੋੜ੍ਹਾ ਕਾੜਾ ਟਾਈਪ ਬਣ ਜਾਂਦਾ ਅਤੇ ਉਸਨੂੰ ਫਿਰ ਪੀ ਕੇ ਅਤੇ ਫਿਰ ਕੰਬਲ ਵਗੈਰਾ ਲੈ ਕੇ ਸੌ ਜਾਈਦਾ ਹੈ ਜਿਸ ਨਾਲ ਉਹ ਪਸੀਨੇ ਦੇ ਥਰੂ ਜੋ ਬਿਮਾਰੀ ਉਹ ਬਾਹਰ ਨਿਕਲ ਜਾਂਦੀ ਹੈ ਅਤੇ ਫਿਰ ਅਗਰ ਕਿਸੇ ਦਾ ਹੈਡਡੇਕ ਹੋ ਰਿਹਾ ਹੋਵੇ ਤਾਂ ਉਸਨੂੰ ਅਸੀਂ ਤੁਲਸੀ ਦੀ ਚਾਹ ਵਗੈਰਾ ਬਣਾ ਕੇ ਦਿੰਦੇ ਹਾਂ ਥੈਂਕ ਯੂ